ਭੰਗੜਾ ਐਰੋਬਿਕ ਹੋਰ ਕਸਰਤ ਵਿਕਲਪਾਂ ਦੇ ਮੁਕਾਬਲੇ ਜ਼ਿਆਦਾ ਦਿਲਚਸਪ ਇਸ ਲਈ ਹੈ ਕਿਉਂਕਿ ਭੰਗੜਾ ਪੰਜਾਬ ਦਾ ਸਭ ਤੋਂ ਜ਼ਿਆਦਾ ਲੋਕਪ੍ਰਿਯ ਲੋਕ ਨਾਚ ਹੈ ਜਿਸ ਨੂੰ ਲੋਕ ਬਹੁਤ ਹੀ ਆਨੰਦ ਨਾਲ ਦੇਖਦੇ ਵੀ ਹਨ ਅਤੇ ਪਾਉਂਦੇ ਵੀ ਹਨ ਅਤੇ ਭੰਗੜਾ ਐਰੋਬਿਕਸ ਕਰਨ ਨਾਲ ਇ ਇੱਕ ਤਾਂ ਜੋ ਨੌਜਵਾਨ ਹੈ ਉਹ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਰਹਿੰਦਾ ਹੈ ਅਤੇ ਦੂਜਾ ਇੱਕ ਇਹ ਵੀ ਫਾਇਦਾ ਹੁੰਦਾ ਹੈ ਕਿ ਉਹਦੀ ਸਿਹਤ ਵੀ ਵਧੀਆ ਰਹਿੰਦੀ ਹੈ ਭੰਗੜੇ ਦੇ ਭੰਗੜੇ ਦੀ ਢੋਲ ਦੇ ਤਾਲ 'ਤੇ ਨੱਚਦੇ ਨੱਚਦੇ ਲੋਕ ਮਜ਼ਾ ਵੀ ਲੈ ਲੈਂਦੇ ਹੈ ਅਤੇ ਤੰਦਰੁਸਤ ਵੀ ਰਹਿੰਦੇ ਹੈ ਇਸ ਕਰਕੇ ਇਹ ਲੋਕ ਨਾਚ ਬਹੁਤ ਜ਼ਿਆਦਾ ਦਿਲਚਸਪ ਹੈ ਪੰਜਾਬ ਵਿੱਚ ਤਾਂ ਇਹਨੂੰ ਬਹੁਤ ਹੀ ਜ਼ਿਆਦਾ ਲੋਕਪ੍ਰਿਅਤਾ ਮਿਲੀ ਹੋਈ ਹੈ ਪਰ ਹੁਣ ਨਾਲ ਨਾਲ ਪੰਜਾਬ ਦੇ ਨਾਲ ਨਾਲ ਇਹ ਹੋਰ ਵੀ ਪੰਜਾਬ ਦੇ ਭਾਰਤ ਵਿੱਚ ਵੀ ਅਤੇ ਭਾਰਤ ਤੋਂ ਬਾਹਰ ਵੀ ਹੁਣ ਭੰਗੜਾ ਬਹੁਤ ਲੋਕਪ੍ਰੀਯਾ ਹੋ ਗਿਆ ਹੈ ਈਵਨ ਬਾਹਰ ਦੇ ਸਟੇਜ 'ਤੇ ਵੀ ਅੱਜ ਕੱਲ੍ਹ ਭੰਗੜਾ ਬਹੁਤ ਜਿਆਦਾ ਵਧੀਆ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਪਾਇਆ ਜਾਂਦਾ ਹੈ ਅਤੇ ਇੱਕ ਇਹ ਤਨਾਵ ਵੀ ਦੂਰ ਕਰਦਾ ਹੈ ਆਪਣੀਆਂ ਹੱਡੀਆਂ ਮਜ਼ਬੂਤ ਰੱਖਦਾ ਹੈ ਇਸ ਕਰਕੇ ਭੰਗੜਾ ਜੋ ਹੈ ਭੰਗੜਾ ਐਰੋਬਿਕਸ ਹੋਰ ਕਸਰਤ ਵਿਕਲਪਾਂ ਦੇ ਮੁਕਾਬਲੇ ਬਹੁਤ ਦਿਲਚਸਪ ਹੈ